ਸਾਡੇ ਖੇਤਰ ਵਿੱਚ ਸਿਹਤ ਸੰਭਾਲ ਦੀ ਗੁਣਵੱਤਾ ਠੀਕ ਵੀ ਆ ਅਤੇ ਨਹੀਂ ਵੀ ਠੀਕ ਆ ਕਿਉਂਕਿ ਜਿਹੜੀ ਇੱਕ ਅਵਸਥਾ ਅੱਜ ਕੱਲ੍ਹ ਚੱਲਣ ਡੀ ਆ ਅਤੇ ਜਿਹੜੀਆਂ ਪ੍ਰਸਥਿਤੀਆਂ ਦਾ ਅੱਜ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਉਹਦੇ ਅਨੁਸਾਰ ਸਾਡੇ ਖੇਤਰ ਵਿੱਚ ਕਸਬੇ ਦੇ ਮੁਕਾਬਲੇ ਗੁਣਵੱਤਾ ਕਾਫੀ ਘੱਟ ਸਿਹਤ ਸੰਭਾਲ ਦੇ ਮਾਮਲੇ 'ਚ ਅਤੇ ਕਿਉਂਕਿ ਇੱਕ ਤਾਂ ਮੰਨ ਲਓ ਸਫਾਈ ਵਗੈਰਾ ਸਾਡੇ ਖੇਤਰ ਵਿੱਚ ਸਫਾਈ ਵਗੈਰਾ ਦਾ ਪ੍ਰੋਪਰ ਪੂਰੀ ਤਰ੍ਹਾਂ ਸੰਪੂਰਨ ਪ੍ਰਬੰਧ ਨਹੀਂ ਹੋ ਪਾਉਂਦਾ ਅਤੇ ਸਿਹਤ ਵਾਸਤੇ ਅਜਿਹੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਜਾਂ ਚੰਗੇ ਚੰਗੇ ਕਲੀਨਿਕ ਬਣੀਆਂ ਹੋਣ ਡਿਸਪੈਂਸਿਸ ਬਣੀਆਂ ਜਾਂ ਹੋਣ ਜਾਂ ਫਿਰ ਹੋਸਪੀਟਲ ਵਗੈਰਾ ਹੋਣ ਅਤੇ ਸਾਫ਼ ਸਫਾਈ ਦਾ ਪ੍ਰੋਪਰ ਪ੍ਰਬੰਧ ਹੋਵੇ ਪੂਰੀ ਤਰ੍ਹਾਂ ਪ੍ਰਬੰਧ ਹੋਵੇ ਅਤੇ ਲੋਕਾਂ ਨੂੰ ਦਵਾਈਆਂ ਵੀ ਚੰਗੀ ਤਰ੍ਹਾਂ ਮਿਲਣ ਅਤੇ ਚੰਗੇ ਡੌਕਟਰ ਉੱਥੇ ਕੰਮ ਕਰਦੇ ਹੋਣ ਕਿਉਂਕਿ ਇਹ ਜਿਹੜੀਆਂ ਅੱਜ ਕੱਲ੍ਹ ਦੀਆਂ ਬਿਮਾਰੀਆਂ ਹੋ ਫੈਲ ਰਹੀਆਂ ਹਨ ਉਹ ਸਾਰੀਆਂ ਵਾਇਰਲ ਹਨ ਅਤੇ ਉਹਨਾਂ ਦੀ ਉਹਨਾਂ ਤੋਂ ਬਚਣ ਲਈ ਵੀ ਇੱਕ ਬਿਲਕੁਲ ਜਿਹੜੇ ਨਿਪੁੰਨ ਹੁੰਦੇ ਨੇ ਆਪਣੇ ਕਿੱਤੇ ਵਿੱਚ ਉਹਨਾਂ ਡੌਕਟਰਾਂ ਦੀ ਲੋੜ ਹੈ ਅਤੇ ਸਾਡੇ ਖੇਤਰ ਵਿੱਚ ਚੰਗੇ ਹੋਸਪਿਟਲ ਦੀ ਵੀ ਹਸਪਤਾਲ ਦੀ ਵੀ ਘਾਟ ਹੈ ਅਤੇ ਚੰਗੇ ਡੌਕਟਰਾਂ ਦੀ ਵੀ ਘਾਟ ਹੈ ਇਸ ਕਰਕੇ ਬਿਹਤਰ ਸਿਹਤ ਸਹੂਲਤਾਂ ਪ੍ਰਾਪਤ ਕਰਨ ਲਈ ਅਸੀਂ ਸ਼ਹਿਰ ਪ੍ਰਵਾਸ ਕਰਨਾ ਪਸੰਦ ਕਰਦੇ ਹਾਂ ਅਤੇ ਜ਼ਰੂਰੀ ਨਹੀਂ ਆ ਕਿ ਸਾਡੇ ਖੇਤਰ ਵਿੱਚ ਸਾਫ਼ ਸਫਾਈ ਜਾਂ ਸ਼ਹਿਰਾਂ 'ਚ ਬਹੁਤ ਸਾਫ਼ ਸਫਾਈ ਆ ਹੁੰਦੀ ਆ ਪਰ ਇਹ ਫ਼ਰਕ ਪੈਂਦਾ ਕਿ ਜਿਹੜੀਆਂ ਸਿਹਤ ਸੰਭਾਲ ਨੂੰ ਸਾਨੂੰ ਜ਼ਰੂਰਤ ਪੈਣ 'ਤੇ ਇੱਕ ਚੰਗੇ ਹਸਪਤਾਲ ਦੀ ਲੋੜ ਪੈਂਦੀ ਹੈ ਚੰਗੇ ਡੌਕਟਰ ਦੀ ਲੋੜ ਪੈਂਦੀ ਹੈ ਤਾਂ ਉਹ ਸਾਨੂੰ ਸੁਵਿਧਾਵਾਂ ਬੜੀ ਜਲਦੀ ਮਿਲ ਜਾਂਦੀਆਂ ਹਨ ਅਤੇ ਸਾਡੇ ਖੇਤਰ ਦੇ ਵਿੱਚ ਇਹਨਾਂ ਚੀਜ਼ਾਂ ਦੀਆਂ ਕਮੀਆਂ ਹਨ ਅਤੇ ਕਈ ਲੋਕਾਂ ਨੂੰ ਤਾਂ ਵਿਚਾਰਿਆਂ ਨੂੰ ਇਲਾਜ ਚੰਗੀ ਤਰ੍ਹਾਂ ਨਾ ਮਿਲਣ ਕਰਕੇ ਉਹਨਾਂ ਦੀ ਜ਼ਿੰਦਗੀ ਖ਼ਤਮ ਹੋ ਚੁੱਕੀ ਹੈ ਅਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਿਹਤ ਸਹੂਲਤਾਂ ਪ੍ਰਾਪਤ ਕਰ ਲਈ ਅਸੀਂ ਸ਼ਹਿਰ 'ਚ ਪ੍ਰਵਾਸ ਕਰਨਾ ਪਸੰਦ ਕਰਦੇ ਹਾਂ ਕਿਉਂਕਿ ਸਾਡੇ ਖੇਤਰ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਕਮੀ ਹੈ